ਸਾਡੇ ਖੇਤਰ ਵਿੱਚ ਕਾਬਲ ਕਲਾਵਾਂ ਵਿੱਚ ਇੱਕ ਚਿੱਤਰਕਾਰੀ ਆਉਂਦੀ ਹੈ ਅਤੇ ਦੂਜਾ ਕ੍ਰਾਫਟ ਦਾ ਕੰਮ ਆਉਂਦਾ ਹੈ ਇਸ ਨੂੰ ਲੋਕ ਬਹੁਤ ਆਸਾਨੀ ਨਾਲ ਸੰਭਾਲ ਲੈਂਦੇ ਹਨ ਕੁਛ ਕੁਛ ਚਿੱਤਰ ਤਾਂ ਆਪਣੇ ਘਰ ਵਿੱਚ ਹੀ ਲਗਾਏ ਜਾ ਸਕਦੇ ਹਨ ਹਨ ਅਤੇ ਆਰਟ ਵਰਕ ਵੀ ਵੇਚ ਕੇ ਵੇਚ ਕੇ ਕਮਾਈ ਕੀਤੀ ਜਾ ਸਕਦੀ ਹੈ ਆਰਟ ਵਰਕ ਕਿਸੇ ਦੇ ਆਰਡਰ 'ਤੇ ਵੀ ਬਣਾ ਸਕਦੇ ਹਨ ਅਤੇ ਚਿੱਤਰ ਚਿੱਤਰ ਵੀ ਆਪਾਂ ਆਰਡਰ 'ਤੇ ਬਣਾ ਸਕਦੇ ਹਨ ਅਤੇ ਫਰੇਮ ਕਰਵਾ ਕੇ ਉਹ ਵੇਚ ਸਕਦੇ ਹਨ ਇਸ ਖੇਤਰ ਵਿੱਚ ਕਮਾਈ ਬਹੁਤ ਹੈ